ਪੇਂਟਿੰਗ ਦੇ ਅਨੁਭਵ ਬਾਰੇ ਮੈਂ ਉਹਨਾਂ ਨਾਲ ਸਲਾਹ ਆ ਸੂਜ ਕਰਨ ਲਈ ਬਿੰਦੂਆਂ ਉੱਤੇ ਜ਼ੋਰ ਦੇਵਾਂਗਾ ਧੀਰਜ ਰੱਖੋ ਪੇਂਟਿੰਗ ਇੱਕ ਅਜਿਹੀ ਪ੍ਰਕਿਆ ਹੈ ਜਿਸ ਵਿੱਚ ਧੀਰਜ ਅਤੇ ਸਮਝਦਾਰੀ ਦੀ ਲੋੜ ਹੁੰਦੀ ਹੈ ਮੂਲ ਬਿੰਦੀਆਂ ਸਿੱਖੋ ਰੰਗ ਰੂਪ ਆਕਾਰ ਅਤੇ ਰਿਖਿਆਵਾਂ ਰੇਖਾ ਦੀਆਂ ਮੂਲ ਬਿੰਦੀਆਂ ਸਮਝੋ ਪ੍ਰੇਰਨਾ ਲਓ ਕਲਾਕਾਰਾਂ 'ਚ ਰੇਤਾ ਚਿੱਤਰਾਂ ਅਤੇ ਕਲਾਂ ਦੀਆਂ ਕਿਤਾਬਾਂ ਤੋਂ ਪਰੋੜੀ ਪ੍ਰੇਰਨਾ ਲਓ ਅਭਿਆਸ ਕਰੋ ਆਪਣੀ ਸ਼ੈਲੀ ਵਿਕਸਿਤ ਕਰੋ ਮਨੋਰੰਜਨ ਪਾਓ